ਵੈਸੇ ਤਾਂ ਪਿੰਡਾਂ ਦੀਆਂ ਖ਼ਬਰਾਂ ਬਹੁਤ ਘੱਟ ਲੱਗਦੀਆਂ ਹਨ ਅਤੇ ਜੇ ਲੱਗਦੀਆਂ ਹਨ ਤਾਂ ਉਹ ਸਹੀ ਢੰਗ ਨਾਲ ਨਹੀਂ ਲੱਗਦੀਆਂ ਜਿਵੇਂ ਕਿ ਪਿੰਡਾਂ ਵਾਲੇ ਲੋਕਾਂ ਨੂੰ ਬਹੁਤ ਹੀ ਅਣਪੜ੍ਹ ਅਤੇ ਸਹੀ ਢੰਗ ਨਾ ਰਹਿਣ ਵਾਲੇ ਦਿਖਾਇਆ ਜਾਂਦਾ ਹੈ ਜ਼ਿਆਦਾਤਰ ਜ਼ਿਆਦਾਤਰ ਖ਼ਬਰਾਂ ਪਿੰਡਾਂ ਵਿੱਚ ਉਦੋਂ ਲੱਗਦੀਆਂ ਹਨ ਜਦੋਂ ਪਿੰਡਾਂ ਵਿੱਚੋਂ ਵੋਟਾਂ ਲੈਣੀਆਂ ਹੋਣ ਉਦੋਂ ਬਹੁਤ ਸਾਰੀਆਂ ਖ਼ਬਰਾਂ ਪਿੰਡਾਂ ਵਿੱਚੋਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਅਤੇ ਪਿੰਡਾਂ ਵਿੱਚ ਖ਼ਬਰਾਂ ਉਹਨਾਂ ਦਾ ਰਹਿਣ ਸਹਿਣ ਸਹੀ ਢੰਗ ਨਾਲ ਨਹੀਂ ਦਿਖਾਇਆ ਜਾਂਦਾ ਜਿੰਨਾ ਸੋਹਣਾ ਪਿੰਡਾਂ ਦਾ ਰਹਿਣ ਸਹਿਣ ਹੈ ਪਿੰਡਾਂ ਦੇ ਖੁੱਲ੍ਹੇ ਵਿਹੜੇ ਨਹੀਂ ਦਿਖਾਏ ਜਾਂਦੇ ਪਿੰਡਾਂ ਦੀਆਂ ਸੱਥਾਂ ਪਿੰਡਾਂ ਦੇ ਗੁਰਦੁਆਰੇ ਅਤੇ ਪਿੰਡਾਂ ਦੇ ਸਕੂਲ ਬਹੁਤ ਚੰਗੇ ਹੁੰਦੇ ਹਨ ਜੋ ਕਿ ਉਹਨਾਂ ਬਾਰੇ ਕੁਛ ਵੀ ਨਹੀਂ ਦੱਸਿਆ ਜਾਂਦਾ ਪਿੰਡਾਂ ਵਿੱਚ ਖ਼ਬਰਾਂ ਇਕੱਠੀਆਂ ਕਰਨ ਲਈ ਬਹੁਤ ਸਾਰੀਆਂ ਵਧੀਆਂ ਚੰਗੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਹਨ ਜੋ ਕਿ ਉਹਨਾਂ ਨੂੰ ਨਹੀਂ ਦਿਖਾਇਆ ਜਾਂਦਾ